ਪੰਜਾਬੀ ਭੰਗੜਾ ਪੰਜਾਬੀ ਭੰਗੜਾ ਲੋਕ ਪ੍ਰਸਿੱਧ ਨਾਚ ਹੈ ਅਤੇ ਇਸ ਨੂੰ ਪੰਜਾਬੀ ਆਪਣੇ ਬੜੇ ਹੀ ਜੋਸ਼ ਨਾਲ ਪਾਉਂਦੇ ਹਨ ਇਸ ਨੂੰ ਮੇਲਿਆਂ ਵਿਆਹ ਸ਼ਾਦੀਆਂ ਤਿਉਹਾਰਾਂ ਦੇ ਵਿੱਚ ਆਪਣੀ ਖੁਸ਼ੀ ਦਾ ਪ੍ਰਗਟਾਵਾ ਅਤੇ ਆਪਣੇ ਜੋਸ਼ ਜਜ਼ਬੇ ਨੂੰ ਪੇਸ਼ ਕਰਨ ਲਈ ਵੀ ਵਰਤਿਆ ਜਾਂਦਾ ਹੈ ਭੰਗੜੇ ਪਾਉਣ ਲਈ ਪੰਜਾਬੀ ਬੋਲੀ ਟਾਂਗੂ ਢੋਲਕ ਚਿਮਟਾ ਆਦਿ ਵਰਤੋਂ ਆਹ ਸਾਜ਼ ਦੀ ਵਰਤੋਂ ਕਰਦੇ ਹਨ ਜਿਸ ਨਾਲ ਇਸ ਨੂੰ ਪਾਇਆ ਜਾਂਦਾ ਹੈ ਅਤੇ ਭੰਗੜਾ ਪਾਉਣ ਲਈ ਸਭ ਤੋਂ ਮਹੱਤਵਪੂਰਨ ਸਾਜ਼ ਅਤੇ ਸੰਗੀਤ ਹੈ ਬੋਲੀ ਅਤੇ ਢੋਲ ਢੋਲ ਰਾਹੀਂ ਪੰਜਾਬੀ ਭੰਗੜਾ ਪਾਇਆ ਜਾਂਦਾ ਹੈ ਕਿ ਢੋਲ ਵਜਾਉਣ ਲਈ ਇੱਕ ਅਲੱਗ ਤੋਂ ਜੋਸ਼ ਚਾਹੀਦਾ ਹੈ ਅਤੇ ਉਸੇ ਜੋਸ਼ ਉਸੇ ਹੀ ਦੁਗਣੇ ਜੋਸ਼ ਨਾਲ ਇਸ ਭੰਗੜੇ ਨੂੰ ਪਾਇਆ ਜਾਂਦਾ ਹੈ ਅਤੇ ਢੋਲ ਜਦੋਂ ਭੰਗੜਾ ਮਿਲਦਾ ਹੈ ਤਾਂ ਇੱਕ ਵਾਰੀ ਇੰਝ ਲੱਗਦਾ ਹੈ ਜਿਵੇਂ ਕਿ ਧਰਤੀ ਹੀ ਹਿਲਦੀ ਹੈ ਕਿਉਂਕਿ ਭੰਗੜਾ ਵੀ ਪੂਰੇ ਜੋਸ਼ ਨਾਲ ਤਾਕਤ ਨਾਲ ਪਾਇਆ ਜਾਂਦਾ ਹੈ ਅਤੇ ਢੋਲ ਵਜਾਉਣ ਲਈ ਵੀ ਸਾਨੂੰ ਓਨੀ ਹੀ ਤਾਕਤ ਚਾਹੀਦੀ ਹੈ ਇਸ ਲਈ ਢੋਲ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਭੰਗੜੇ ਪਾਉਣ ਲਈ ਹੋਰ ਬਥੇਰੇ ਸੰਗੀਤ ਅਤੇ ਸਾਜ਼ ਹਨ ਜਿਵੇਂ ਟਾਂਗੂ ਕ ਕੜ੍ਹਾ ਬੋਲੀਆਂ ਆਦਿ ਹਨ ਜਿਸ ਨਾਲ ਭੰਗੜਾ ਵੀ ਪਾਇਆ ਜਾਂਦਾ ਪਰ ਢੋਲ ਦਾ ਇੱਕ ਅਲੱਗ ਤੋਂ ਮਹੱਤਵਪੂਰਨ ਹੈ ਕਿਉਂਕਿ ਢੋਲ ਦੀ ਧੁੰਨ ਦੇ ਨਾਲ ਹੀ ਭੰਗੜੇ ਪਾਉਣ ਦਾ ਜਿਹੜਾ ਜੋਸ਼ ਅਲੱਗ ਤੋਂ ਜਾਂਦਾ ਹੈ ਜਿਸ ਦਾ ਵੀ ਮਤਲਬ ਮਨ ਵੀ ਨਹੀਂ ਕਰਦਾ ਅਗਰ ਉਹ ਢੋਲ ਦੀ ਧੁੰਨ ਵੀ ਸੁਣਦਾ ਹੈ ਤਾਂ ਔ ਆਪਣੇ ਆਪ ਹੀ ਉਸ ਦੇ ਪੈਰ ਜਿਹੜੇ ਡਗਮਗਾਉਣ ਲੱਗ ਜਾਂਦੇ ਹਨ ਅਤੇ ਉਹ ਵੀ ਆਪਣਾ ਅੰਦਰੋਂ ਅੰਦਰੀ ਹੀ ਭੰਗੜਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਪੰਜਾਬੀ ਲੋ ਲੋਕਾਂ ਨੂੰ ਚਲਦੇ ਫਿਰਦੇ ਕਹਿੰਦੇ ਜਿੱਥੇ ਚਾਰ ਪੰਜਾਬੀ ਇਕੱਠੇ ਹੋ ਜਾਣ ਉੱਥੇ ਮੇਲਾ ਤਿਆਰ ਹੋ ਜਾਂਦਾ ਹੈ ਇਸੇ ਚੱਕਰ 'ਚ ਪੰਜਾਬੀਆਂ ਦਾ ਪ੍ਰਸਿੱਧ ਨਾਚ ਭੰਗੜਾ ਹੈ ਕਿਉਂਕਿ ਇਹ ਪੂਰੇ ਜੋਸ਼ ਅਤੇ ਜੋਸ਼ੀਲੇਪਨ ਦਾ ਭਾਵ ਦੱਸਦਾ ਹੈ